ਕਈ ਤਰ੍ਹਾਂ ਦੀਆਂ ਵੱਖ ਵੱਖ ਰਸਮਾਂ ਹਨ ਜੋ ਕਿ ਇੱਕ ਨਵ ਜੰਮੇ ਬੱਚੇ ਲਈ ਅਤੇ ਉਸਦੇ ਪਹਿਲੇ ਸਾਲ ਦੇ ਵਿੱਚ ਕੀਤੀਆਂ ਜਾਂਦੀਆਂ ਹਨ ਜਿਵੇਂ ਕਿ ਦੁੱਧੀਆਂ ਧੋਣ ਦੀ ਰਸਮ ਬੱਚਾ ਜੰਮਣ 'ਤੇ ਦੁੱਧੀਆਂ ਧੋਣ ਦੀ ਰਸਮ ਅਦਾ ਕੀਤੀ ਜਾਂਦੀ ਹੈ ਇਸ ਰਸਮ ਦੇ ਵਿੱਚ ਸਵਾ ਰੁਪਈਆ ਜਾਂ ਕੱਪੜੇ ਮਿਲਦੇ ਹਨ ਹਰੇ ਘਾਹ ਦੀ ਗੁੱਥੀ ਦੇ ਨਾਲ ਦੁੱਧੀਆਂ ਧੋਤੀਆਂ ਜਾਂਦੀਆਂ ਹਨ ਬਾਂਦਰ ਵਾਲ ਟਿਕਾਉਣਾ ਮੁੰਡਾ ਹੋਣ ਦੀ ਸੂਰਤ ਦੇ ਵਿੱਚ ਘਰ ਦੇ ਅੱਗੇ ਅੰਬ ਦੇ ਪੱਤਿਆਂ ਦਾ ਬਾਂਦਰ ਵਾਲ ਲਟਕਾਇਆ ਜਾਂਦਾ ਹੈ ਜੋ ਕਿ ਇੱਕ ਖੁਸ਼ੀ ਦਾ ਪ੍ਰਤੀਕ ਹੁੰਦਾ ਹੈ ਗੁੜਤੀ ਦੇਣਾ ਗੁੜਤੀ ਦੇਣਾ ਇੱਕ ਖਾਸ ਰਸਮ ਹੈ ਗੁੜਤੀ ਦੇਣਾ ਕਿਤੇ ਛੋਟੀ ਜਿਹੀ ਗੱਲ ਨਹੀਂ ਹੈ ਇਹ ਗੁੜਤੀ ਜਿਸ ਚੀਜ਼ ਦੀ ਵੀ ਦਿੱਤੀ ਜਾਵੇਗੀ ਉਸ ਬੱਚੇ ਦਾ ਸੁਭਾਅ ਉਸਦੇ ਉੱਪਰ ਜਾਂਦਾ ਹੈ ਅੱਜਕੱਲ੍ਹ ਸ਼ਹਿਦ ਨੂੰ ਉਂਗਲ ਦੇ ਨਾਲ ਲਗਾ ਲਗਾ ਕੇ ਚਟਾ ਦਿੱਤਾ ਜਾਂਦਾ ਹੈ ਹੁਣ ਗੁੜਤੀ ਦੇਣ ਦਾ ਰਿਵਾਜ ਇਹੀ ਹੈ ਖੁਸਰਿਆਂ ਨੂੰ ਨਚਾਉਣਾ ਖੁਸ਼ੀਆਂ ਨੂੰ ਵੀ ਖੁਸ ਇਸ ਖੁਸ਼ੀ ਦੇ ਵਿੱਚ ਸ਼ਰੀਕ ਕੀਤਾ ਜਾਂਦਾ ਹੈ ਲੜਕੇ ਜੰਮਣ ਤੋਂ ਬਾਅਦ ਖੁਸਰਿਆਂ ਦਾ ਜੱਥਾ ਦਾਦਕਿਆਂ ਦੇ ਘਰ ਪਹੁੰਚ ਜਾਂਦਾ ਖੁਸਰੇ ਆਪਣੇ ਪੈਰਾਂ ਨੂੰ ਘੁੰਗਰੂ ਬੰਨ੍ਹ ਕੇ ਢੋਲਕੀ ਦੀ ਤਾਲ ਦੇ ਉੱਪਰ ਬੋਲੀਆਂ ਪਾ ਕੇ ਨੱਚਦੇ ਹਨ ਅਤੇ ਉਹ ਦੂਜਿਆਂ ਨੂੰ ਵੀ ਨੱਚਣ ਲਈ ਪ੍ਰੇਰਿਤ ਕਰਦੇ ਹਨ ਖੁਸਰਿਆਂ ਦੇ ਵੱਲੋਂ ਗੀਤਾਂ ਦੇ ਟੋਟਕੇ ਸੁਣਾ ਕੇ ਸਾਰਿਆਂ ਕੋਲੋਂ ਪੈਸੇ ਦੀ ਗੁਰਿਆਈ ਵੀ ਕੀਤੀ ਜਾਂਦੀ ਹੈ ਬੱਚੇ ਦਾ ਨਾਮਕਰਨ ਦੀ ਰਸਮ ਬੱਚੇ ਦੇ ਨਾਂ ਰੱਖਣ ਦਾ ਪੰਜਾਬ ਵਿੱਚ ਕੋਈ ਖਾਸ ਰਸਮ ਨਹੀਂ ਕੀਤੀ ਜਾਂਦੀ ਉਸ ਦੇ ਪਰਿਵਾਰ ਵਿੱਚੋਂ ਜਿਸ ਦੇ ਕੋਈ ਵੀ ਨਾਪ ਅਚ ਵਧੀਆ ਲੱਗਦਾ ਹੈ ਉਹੀ ਰੱਖ ਲੈਂਦਾ ਹੈ ਕੁਝ ਲੋਕ ਆਪਣੇ ਇਲਾਕੇ ਦੇ ਵਿੱਚ ਪੰਡਤ ਜਾਂ ਗ੍ਰੰਥੀ ਸਿੰਘ ਕੋਲੋਂ ਨਾਂ ਦੀ ਰਸਮ ਅਦਾ ਕਰਵਾ ਲੈਂਦੇ ਹਨ ਸਵਾ ਮਹੀਨੇ ਹੋਣ 'ਤੇ ਬੱਚਾ ਅਤੇ ਉਸ ਦੀ ਮਾਂ ਨੂੰ ਦਾਦਾ ਦਾਦੀ ਆਪਣੇ ਘਰ ਲੈ ਜਾਂਦੇ ਹਨ ਲੜਕੀ ਨੂੰ ਤੋਰਨ ਵੇਲੇ ਉਸਦੇ ਪੇਕਾ ਮਾਪਿਆਂ ਵੱਲੋਂ ਉਸ ਨੂੰ ਅਤੇ ਉਸਦੇ ਬੱਚੇ ਦੇ ਦਾਦਕੇ ਮੈਂਬਰਾਂ ਵੱਲੋਂ ਕੱਪੜੇ ਅਤੇ ਗਹਿਣੇ ਦਿੱਤੇ ਜਾਂਦੇ ਹਨ ਇਹ ਕੁਝ ਖਾਸ ਰਸਮਾਂ ਹਨ ਜੋ ਕਿ ਬੱਚੇ ਦੇ ਪਹਿਲੇ ਸਾਲ ਦੇ ਵਿੱਚ ਕੀਤੀਆਂ ਜਾਂਦੀਆਂ ਹਨ